ਹੈਲੋ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਤੋਂ ਗੱਲ ਕਰਦੇ ਹੋ ਜੀ ਮੈਂ ਇੱਥੋਂ ਦੀ ਨਾ ਸੰਸਸਾ ਦਾ ਬਹੁਤ ਨਾਂ ਸੁਣਿਆ ਅਤੇ ਅਸੀਂ ਨਾ ਪਟਿਆਲੇ ਦੇ ਕੋਲ ਸਾਡਾ ਪਿੰਡ ਹੈ ਅਸੀਂ ਉੱਥੋਂ ਗੱਲ ਕਰ ਰਹੇ ਹਾਂ ਅਤੇ ਇੱਥੋਂ ਇਹਨਾਂ ਨੌਜਵਾਨ ਜਿਹੜੇ ਵਰਗ ਦੇ ਬੰਦੇ ਮੁੰਡੇ ਆ ਬੱਚੇ ਨੇ ਉਹਨਾਂ ਨੇ ਮਿਲ ਕੇ ਨਾ ਇੱਕ ਚਲਾਈ ਸੀ ਪਿੰਡ ਦੇ ਵਿੱਚ ਵਿੱਚ ਅਤੇ ਉਹਨਾਂ ਵੱਲੋਂ ਨਾ ਬਹੁਤ ਪੈਸੇ ਇਕੱਠੇ ਕੀਤੇ ਗਏ ਨੇ ਅਸੀਂ ਨਾ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਅਸੀਂ ਤੁਹਾਡੀ ਸੋਸਾਇਟੀ ਦਾ ਨਾਮ ਸੁਣਿਆ ਅਤੇ ਤੁਹਾਡੀ ਸੋਸਾਇਟੀ ਰਾਹੀਂ ਅਸੀਂ ਇਹ ਸਾਰਾ ਪ੍ਰਮੋਟ ਕਰਨਾ ਚਾਹੁੰਦੇ ਹਾਂ ਜੋ ਵੀ ਅਸੀਂ ਸੇਵਾ ਕਰ ਰਹੇ ਹਾਂ ਅਤੇ ਮੈਨੂੰ ਤੁਹਾਡੀ ਸੋਸਾਇਟੀ ਦੇ ਮਿਸ਼ਨ ਦਾ ਪਤਾ ਲੱਗ ਸਕਦਾ ਜੀ ਠੀਕ ਹੈ ਜੀ ਅਤੇ ਤੁਹਾਡੇ ਪ੍ਰੋਜੈਕਟ ਕਿਹੜੇ ਕਿਹੜੇ ਚੱਲ ਰਹੇ ਨੇ ਜੀ ਹੁਣ ਕੋਈ ਸਰੀਰਕ ਸੁਵਿਧਾ ਤੁਸੀਂ ਪ੍ਰਬੰਧ ਕੀਤੀ ਹੋਈ ਸੀ ਜੀ ਅਤੇ ਤੁਸੀਂ ਸਾਡੇ ਇੱਥੇ ਵੀ ਕੈਂਪ ਲਾ ਲਿਓ ਜੀ ਆ ਕੇ ਅਤੇ ਨਾਲ ਆਪਣਾ ਮੇਲ ਜੋਲ ਬਣ ਜਾਏਗਾ ਅਤੇ ਅਸੀਂ ਵੀ ਥੋੜ੍ਹਾ ਆਪਣੇ ਜੋ ਵੀ ਅਸੀਂ ਸੰਸਥਾ ਚਲਾਈ ਹੋਈ ਅਸੀਂ ਉਸ 'ਤੇ ਚਾਨਣ ਪਾ ਸਕਾਂਗੇ ਅਤੇ ਲੋਕਾਂ ਨੂੰ ਜਾਗਰੂਕ ਕਰ ਸਕਾਂਗੇ ਤੁਹਾਡੀ ਹੈਲਪ ਦੇ ਨਾਲ ਠੀਕ ਹੈ ਜੀ ਪਿੰਡ ਦਾ ਨਾਮ ਘੜਾਵੇਂ ਅਤੇ ਅਸੀਂ ਕੁਛ ਕੁਛ ਪੈਸੇ ਜੋੜੇ ਹੋਏ ਨੇ ਉਹ ਪੈਸੇ ਵੀ ਅਸੀਂ ਤੁਹਾਨੂੰ ਦੇਵਾਂਗੇ ਜੀ ਸੰਸਥਾ ਧੰਨਵਾਦ ਤੁਹਾਡਾ ਕਰਨਾ ਚਾਹੀਦਾ ਤੁਸੀਂ ਐਡੀ ਵੱਡੀ ਸੋਸਾਇਟੀ ਚਲਾ ਰਹੇ ਹੋ ਜੀ ਚਲੋ ਠੀਕ ਹੈ ਜੀ ਤੁਸੀਂ ਪਿੰਡ ਆ ਕੇ ਕੈਂਪ ਲਾਇਓ ਅਤੇ ਸਾਨੂੰ ਦੱਸ ਦਿਓ ਅਤੇ ਕੈਂਪ ਦਾ ਆਪਾਂ ਮਿਲ ਕੇ ਨਿਯੁਕਤ ਕਰ ਲਾਂਗੇ ਕਿ ਕਿਹੜੇ ਸਮੇਂ ਆਪਾਂ ਕੈਂਪ ਲਾਣਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ